ਸਾਡੇ ਰਾਜ ਵਿੱਚ ਗੁਰੂ ਅਤੇ ਪੁਜਾਰੀ ਹੀ ਪਾਏ ਜਾਂਦੇ ਨੇ ਜਿਸ ਤਰ੍ਹਾਂ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਅਸੀਂ ਲੋਕ ਸਿੱਖ ਲੋਕ ਗੁਰੂ ਘਰ ਜਾਂਦੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਗੁਰੂਆਂ ਦੀ ਹੀ ਜੋਤ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਕਿ ਗੁਰੂ ਘਰ ਵਿੱਚ ਲੋਕ ਮੱਥਾ ਟੇਕਦੇ ਨੇ ਪ੍ਰਸ਼ਾਦ ਲੈਂਦੇ ਨੇ ਗੁਰਬਾਣੀ ਕੀਰਤਨ ਸੁਣਦੇ ਨੇ ਇੱਥੇ ਗੁਰਪੁਰਬ ਦਸਾਂ ਗੁਰੂਆਂ ਦੇ ਗੁਰਪੁਰਬ ਅਤੇ ਨਾਲ ਹੀ ਵਿਸਾਖੀ ਬੜੇ ਵਧੀਆ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਉਸ ਦਿਨ ਪਾਠ ਹੁੰਦੇ ਨੇ ਕੀਰਤਨ ਚਲਦੇ ਨੇ ਲੰਗਰ ਲੱਗਦੇ ਨੇ ਸਾਰੇ ਹੀ ਗੁਰੂ ਘਰਾਂ ਵਿੱਚ ਜਿਸ ਦਿਨ ਮਰਜ਼ੀ ਜਦੋਂ ਮਰਜ਼ੀ ਚਲ ਜੋ ਗੁਰੂ ਘਰ ਵਿੱਚ ਲੰਗਰ ਦਿਨ ਰਾਤ ਚੱਲਦੇ ਨੇ ਸਾਨੂੰ ਸਾਨੂੰ ਸਾਰੇ ਗੁਰੂ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਦੂਜੇ ਨੰਬਰ 'ਤੇ ਹਿੰਦੂ ਧਰਮ ਹਿੰਦੂ ਧਰਮ ਵਿੱਚ ਪੁਜਾਰੀ ਪਾਏ ਜਾਂਦੇ ਨੇ ਜੋ ਕਿ ਮੰਦਰਾਂ ਵਿੱਚ ਮੰਦਰਾਂ ਵਿੱਚ ਪੂਜਾ ਕਰਦੇ ਨੇ ਇਸ ਤੋਂ ਇਲਾਵਾ ਉਹ ਛੱਟ ਪੂਜਾ ਛੱਟ ਪੂਜਾ ਨਾਮ ਕਰਨ ਹੋਵੇ ਤਾਂ ਵੀ ਉਹ ਹਿੰਦੂ ਧਰਮ ਵਿੱਚ ਬੱਚਾ ਜਨਮ ਲੈਂਦਾ ਹੈ ਤਾਂ ਉਸਦੇ ਨਾਮ ਕਰਨ 'ਤੇ ਵੀ ਪੂਜਾ ਕੀਤੀ ਜਾਂਦੀ ਹੈ ਉਸਦੇ ਉਸ ਤੋਂ ਇਲਾਵਾ ਕੋਈ ਕਿਸੇ ਦੀ ਮੌਤ ਹੋ ਜਾਵੇ ਤਾਂ ਵੀ ਪੂਜਾ ਕੀਤੀ ਜਾਂਦੀ ਹੈ ਕੋਈ ਵੀ ਕਿਸੇ ਵੀ ਧਰਮ ਦੇਵੀ ਦੇਵਤਿਆਂ ਦੇ ਉਹਨਾਂ ਦੇ ਆਪਣਿਆਂ ਦੇ ਗੁਰੂ ਜਿਸ ਤਰ੍ਹਾਂ ਉਨ੍ਹਾਂ ਦੇ ਮੰਦਰਾਂ ਦੇ ਆਪੋ ਆਪਣੇ ਮਾਤਾ ਦੇ ਨਰਾਤੇ ਹੁੰਦੇ ਨੇ ਅਤੇ ਉਦੋਂ ਪੂਜਾ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸਾਰਿਆਂ ਦੇ ਆਪੋ ਆਪਣੇ ਧਰਮ ਨੇ ਸਾਰੇ ਸਾਰੇ ਹੀ ਧਰਮ ਇੱਕੋ ਜਿਹੇ ਨੇ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦੇਣਾ ਚਾਹੀਦਾ ਹੈ